ਅੱਜ ਦੇ ਸਮੇਂ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਪੌਦੇ ਫ਼ੁੱਲਾਂ ਵਾਲੇ ਫਲ ਵਾਲੇ ਅਤੇ ਸਬਜ਼ੀਆਂ ਦੀਆਂ ਹਜ਼ਾਰਾਂ ਹੀ ਕਿਸਮਾਂ ਬਜ਼ਾਰਾਂ ਦੇ ਵਿੱਚ ਉਪਲਬਧ ਹਨ ਪਰ ਕਈ ਕਿਸਮਾਂ ਸਾਡੇ ਸ਼ੌਕ ਸ਼ੌਕ ਦੇ ਹਿਸਾਬ ਨਾਲ ਹੁੰਦੀਆਂ ਹਨ ਜਿਸ ਦੇ ਵਿੱਚ ਕਈ ਫੁੱਲਾਂ ਵਾਲੇ ਪੌਦੇ ਫਲਾਂ ਵਾਲੇ ਪੌਦੇ ਛਾਂਦਾਰ ਪੌਦੇ ਅਤੇ ਖਾਣ ਵਾਲੀਆਂ ਸਬਜ਼ੀਆਂ ਮੁੱਖ ਹਨ ਅਸੀਂ ਆਪਣੇ ਅਲੱਗ ਅਲੱਗ ਜਗ੍ਹਾ ਦੇ ਹਿਸਾਬ ਨਾਲ ਇਸ ਤਰ੍ਹਾਂ ਦੇ ਪੌਦਿਆਂ ਦਾ ਚਾਈਨ ਕਰਦੇ ਹਾਂ ਤਾਂ ਜੋ ਅਸੀਂ ਉਸ ਜਗ੍ਹਾ ਦਾ ਵੀ ਫਾਇਦਾ ਲੈ ਸਕੀਏ ਅਤੇ ਪੌਦਿਆਂ ਤੋਂ ਮਿਲਣ ਵਾਲੀ ਉਪਲਬਧੀ ਛਾਂ ਫਲ ਫੁੱਲ ਅਤੇ ਸਬਜ਼ੀਆਂ ਦਾ ਅਸੀਂ ਆਪਣੀ ਨਿੱਜੀ ਜੀਵਨ ਦੇ ਵਿੱਚ ਉਪਯੋਗ ਕਰ ਸਕੀਏ ਅਸੀਂ ਸ ਔਰਗੈਨਿਕ ਸਬਜ਼ੀਆਂ ਬਿਨਾਂ ਰੇਅ ਸਪਰੇਹਾਂ ਵਾਲੀਆਂ ਸਬਜ਼ੀਆਂ ਆਪਣੇ ਘਰੇਲੂ ਬਗੀਚੇ ਵਿੱਚ ਵੀ ਉਗਾਉਂਦੇ ਹਾਂ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਕੀਟਨਾਸ਼ਕਾਂ ਦੀ ਲੋੜ ਤੋਂ ਵੱਧ ਵਰਤੋਂ ਇਨਸਾਨੀ ਸਰੀਰ ਲਈ ਘਾਤਕ ਹੈ ਵੱਖ ਵੱਖ ਤਰ੍ਹਾਂ ਦੀਆਂ ਬਿਮਾਰੀਆਂ ਜੋ ਸਾਡੇ ਸਰੀਰ ਨੂੰ ਲੱਗ ਰਹੀਆਂ ਹਨ ਉਹਨਾਂ ਦਾ ਪ੍ਰਣਾਮ ਸਾਨੂੰ ਹਰ ਅਨੇਕਾਂ ਤਰ੍ਹਾਂ ਦੀਆਂ ਦਵਾਈਆਂ ਖਾਣਾ ਖਾਣੀਆਂ ਪੈਂਦੀਆਂ ਹਨ ਇਹਨਾਂ ਕੀਟਨਾਸ਼ਕਾਂ ਨੂੰ ਰੋਕਣ ਲਈ ਸਾਨੂੰ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਜੋ ਜਗ੍ਹਾ ਸਾਡੇ ਕੋਲ ਉਪਲਬਧ ਹੈ ਉਸਦੇ ਵਿੱਚ ਸਾਨੂੰ ਬੇਲਾਂ ਵਾਲੀਆਂ ਸਬਜ਼ੀਆਂ ਅਤੇ ਧਰਤੀ ਦੇ ਵਿੱਚ ਜੜ੍ਹ ਵਾਲੀਆਂ ਸਬਜ਼ੀਆਂ ਉਗਾਉਣੀਆਂ ਚਾਹੀਦੀਆਂ ਹਨ ਜਿਹਨਾਂ ਦਾ ਸਵਾਦ ਬਜ਼ਾਰ ਦੀਆਂ ਸਬਜ਼ੀਆਂ ਨਾਲੋਂ ਦੁੱਗਣਾ ਹੁੰਦਾ ਹੈ ਅਤੇ ਇਸ ਨੂੰ ਉਗਾਉਣ ਦੇ ਵਿੱਚ ਜੋ ਸ਼ਾਂਤੀ ਮਿਲਦੀ ਹੈ ਜੋ ਸਾਨੂੰ ਖੁਸ਼ੀ ਮਿਲਦੀ ਹੈ ਉਹ ਕਿਤੇ ਬਜ਼ਾਰੋਂ ਨਹੀਂ ਮਿਲਦੀ ਸਾਨੂੰ ਅੱਜ ਦੇ ਟਾਈਮ ਦੇ ਵਿੱਚ ਫਲਾਂ ਵਾਲੇ ਬੂਟੇ ਵੀ ਆਪਣੇ ਘਰਾਂ ਦੇ ਵਿੱਚ ਜਾਂ ਖੇਤਾਂ ਦੇ ਵਿੱਚ ਲਾਉਣੇ ਚਾਹੀਦੇ ਹਨ ਫਲਾਂ ਵਾਲੇ ਬੂਟੇ ਘੱਟ ਜਗ੍ਹਾ ਦੇ ਵਿੱਚ ਵੀ ਹੋ ਜਾਂਦੇ ਹਨ ਜਿਸ ਤਰ੍ਹਾਂ ਕਿੰਨੂ ਦੇ ਔਰ ਝਾੜੀਦਾਰ ਬੂਟੇ ਨਿੰਬੂ ਜਾਤੀ ਦੇ ਬੂਟੇ ਅਸੀਂ ਘੱਟ ਜਗ੍ਹਾ ਦੇ ਵਿੱਚ ਵੀ ਲਗਾ ਸਕਦੇ ਹਾਂ ਅਸੀਂ ਆਪਣੀ ਬਗੀਚੀ ਦੇ ਵਿੱਚ ਅੱਜ ਬਹੁਤ ਤਰ੍ਹਾਂ ਦੇ ਪੌਦੇ ਲਗਾਏ ਹਨ ਅਤੇ ਬੇਲਾਂ ਵਾਲੇ ਪੌਦੇ ਕੱਦੂ ਤੋਰੀ ਅਸੀਂ ਗਰਮੀਆਂ ਦੇ ਵਿੱਚ ਖੂਬ ਆਨੰਦ ਨਾਲ ਖਾਂਦੇ ਹਾਂ